ਮੇਰਾ ਨਾਮ ਨੈਨਸੀ ਹੈ ਮੈਂ ਤੁਹਾਨੂੰ ਗਊ ਮਾਤਾ ਬਾਰੇ ਕੁਛ ਦੱਸਣਾ ਚਾਹੁੰਦੀ ਹਾਂ ਗਊ ਸਾਡੀ ਮਾਤਾ ਹੁੰਦੀ ਹੈ ਅਸੀਂ ਆਪਣੇ ਘਰ ਵਿੱਚ ਗਊ ਰੱਖੀ ਹੈ ਲੋਕ ਗਊ ਨੂੰ ਬਹੁਤ ਹੀ ਪੂਜਦੇ ਹਨ ਅਸੀਂ ਇਹਨਾਂ ਦੇ ਗੋਬਰ ਤੋਂ ਕੱਚੇ ਘਰ ਨੂੰ ਲਿੱਪਦੇ ਹਾਂ ਸਾਡੇ ਪੁਰਾਣੇ ਕੱਚੇ ਘਰਾਂ ਵਿੱਚ ਫਰਸ਼ ਨਹੀਂ ਹੈ ਜੋ ਕਿ ਪੁਰਾਣੇ ਲੋਕਾਂ ਦੇ ਘਰਾਂ ਵਿੱਚ ਪਹਿਲਾ ਫਰਸ਼ ਨਹੀਂ ਹੁੰਦੇ ਸੀ ਜੋ ਕਿ ਉਹ ਗਊ ਦੇ ਗੋਬਰ ਤੋਂ ਘਰ ਲਿ ਘਰ ਨੂੰ ਲਿੱਪਦੇ ਹਨ ਹੁਣ ਵੀ ਕਈ ਪਿੰਡਾਂ ਵਿੱਚ ਐਵੇਂ ਹੀ ਗੋਬਰ ਦਾ ਪੋਚਾ ਫੇਰਦਾ ਫੇਰਦੇ ਨੇ ਇਸ ਨਾਲ ਮੱਖੀਆਂ ਮੱਛਰ ਵਗੈਰਾ ਨਹੀਂ ਹੁੰਦੇ ਅੱਜ ਵੀ ਕਈ ਪਿੰਡਾਂ ਵਿੱਚ ਲੋਕ ਇਸਦਾ ਇਸਤੇਮਾਲ ਕਰਦੇ ਹਨ ਹੁਣ ਦੇ ਸਮੇਂ ਵਿੱਚ ਬਹੁਤ ਕੁਝ ਬਦਲ ਗਿਆ ਹੈ ਸਾਡੇ ਪਿੰਡ ਸਾਡੇ ਘਰ ਵਿੱਚ ਵੀ ਹੁਣ ਤੰਦੂਰ ਤੰਦੂਰ ਹੁੰਦਾ ਹੈ ਅਸੀਂ ਉਸ ਤੰਦੂਰ ਨੂੰ ਗਊ ਦੇ ਗੋਬਰ ਨਾਲ ਲਿੱਪਦੇ ਹਾਂ ਜੋ ਕਿ ਉਸ ਵਿੱਚ ਵਧੀਆ ਅੱਗ ਬਲਦੀ ਹੈ